ਪੰਜਾਬ ਵਿੱਚ ਮੁੱਖ ਸੱਭਿਆਚਾਰ ਅਤੇ ਸਮਾਜਿਕ ਸਮੂਹ ਦੇ ਵਿੱਚ ਸਾ ਸਾਡੇ ਰਾਜ ਦੀ ਅਮੀਰ ਸੱਭਿਅਤਾ ਇਹ ਹੈ ਕਿ ਉਸ ਦੇ ਵਿੱਚ ਸਾਰਿਆਂ ਧਰਮਾਂ ਜਾਤਾਂ ਅਤੇ ਨਸਲਾਂ ਦੇ ਲੋਕ ਸਭ ਮਿਲ ਕੇ ਰਹਿੰਦੇ ਹਨ ਅਸੀਂ ਜਦੋਂ ਵੀ ਕੋਈ ਤਿਉਹਾਰ ਜਾਂ ਕੁਝ ਵੀ ਹੁੰਦਾ ਹੈ ਰੀਤੀ ਰਿਵਾਜ਼ ਹੁੰਦੇ ਹਨ ਉਹ ਸਾਰੇ ਬਿਨਾ ਕਿਸੇ ਭੇਦਭਾਵ ਦੇ ਆਪਸ ਵਿੱਚ ਮਿਲ ਕੇ ਰਲ ਮਿਲ ਕੇ ਮਨਾਉਂਦੇ ਹਾਂ ਜਿਵੇਂ ਕਿ ਅਸੀਂ ਲੋਹੜੀ ਦਾ ਤਿਉਹਾਰ ਮਨਾਉਂਦੇ ਹਾਂ ਅਤੇ ਅਸੀਂ ਸਭ ਧਰਮਾਂ ਦੇ ਲੋਕ ਆਪਸ ਵਿੱਚ ਮਿਲ ਕੇ ਬੈਠ ਕੇ ਇੱਕ ਦੂਸਰੇ ਦੇ ਨਾਲ ਖੁਸ਼ੀਆਂ ਸਾਂਝੀਆਂ ਕਰਕੇ ਹੇ ਆਪਸ ਵਿੱਚ ਰਲ ਮਿਲ ਕੇ ਮਨਾਉਂਦੇ ਹਾਂ ਇਹਦੇ ਨਾਲ ਹੈਗਾ ਜਿਹੜਾ ਕਿ ਸਾਡਾ ਜਾਤ ਨਸਲ ਜਾਂ ਭਾਸ਼ਾ ਜਾਂ ਧਰਮ ਦਾ ਕੋਈ ਵੀ ਵਿਤਕਰਾ ਨਹੀਂ ਰਹਿ ਜਾਂਦਾ ਅਸੀਂ ਸਭ ਇੱਕ ਦੂਜੇ ਦੇ ਨਾਲ ਇੱਕ ਵਰਗ ਵਿੱਚ ਇਕੱਠੇ ਹੋ ਕੇ ਹੈ ਨਾ ਵੀ ਇੱਕ ਦੂਸਰੇ ਦੇ ਨਾਲ ਮਿਲ ਕੇ ਆਪਣਾ ਜਿਹੜਾ ਕੋਈ ਵੀ ਦਿ ਦਿਨ ਤਿਉਹਾਰ ਜਾਂ ਰੀਤੀ ਰਿਵਾਜ਼ ਰਲ ਮਿਲ ਕੇ ਮਨਾਉਂਦੇ ਹਾਂ ਜਿਵੇਂ ਕਿ ਹੋਲੀ ਦਾ ਤਿਉਹਾਰ ਹੈ ਉਹਦੇ ਉਸ ਦੇ ਵਿੱਚ ਵੀ ਕੋਈ ਰੰਗ ਜਾਂ ਨਸਲ ਜਾਂ ਕੋਈ ਵੀ ਵਿਤਕਰਾ ਨਹੀਂ ਕੀਤਾ ਜਾਂਦਾ ਇਹੀ ਸਭ ਜਿਹੜਾ ਅਸੀਂ ਦੇਸ਼ ਰਾਜ ਦੇ ਵਿੱਚ ਮਿਲ ਜੁਲ ਕੇ ਸਭ ਧਰਮ ਮਨਾਉਂਦੇ ਹਾਂ ਇੱਕ ਵਰਗ ਦੇ ਵਿੱਚ ਇਹਨੂੰ ਅਸੀਂ ਹੀ ਉਸ ਦੇਸ਼ ਦੀ ਅਮੀਰ ਸੱਭਿਅਤਾ ਨਾ ਨਾਲ ਜੋੜਦੇ ਹਾਂ ਇਹੀ ਉਸ ਦੇਸ਼ ਦੀ ਅਮੀਰ ਸੱਭਿਅਤਾ ਹੈ ਜਿਸ ਵਿੱਚ ਸਭ ਲੋਕ ਆਪਸ ਵਿੱਚ ਮਿਲ ਕੇ ਬਿਨਾ ਕਿਸੇ ਭੇਦ ਭਾਵ ਤੋਂ ਰਲ ਮਿਲ ਕੇ ਤਿਉਹਾਰ ਮਨਾਉਂਦੇ ਹਨ ਇਕੱਠੇ ਹੁੰਦੇ ਹਨ ਅਤੇ ਆਪਣੀਆਂ ਅਤੇ ਖੁਸ਼ੀਆਂ ਸਾਂਝੀਆਂ ਕਰਦੇ ਹਨ ਇਸ ਦੇ ਵਿੱਚ ਕੋਈ ਵੀ ਕਿਸੇ ਵੀ ਜਾਤ ਜਾਂ ਨਸਲ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਸਭ ਇੱਕ ਦੂਜੇ ਨਾਲ ਰਲ ਮਿਲ ਕੇ ਇਹ ਤਿਉਹਾਰ ਜਾਂ ਖੁਸ਼ੀਆਂ ਮਨਾਉਂਦੇ ਹਨ